ਜੀ ਹਾਂ ਮੈਂ ਇੱਕ ਅਜਿਹੀ ਕਿਤਾਬ ਪੜ੍ਹੀ ਹੈ ਜੋ ਸੱਚਮੁੱਚ ਹੀ ਸੋਚ ਨੂੰ ਉਕਸਾਉਣ ਵਾਲੀ ਲੱਗੀ ਔਰ ਇਹ ਇੱਕ ਸੋਹਣ ਸਿੰਘ ਦੀ ਕਿਤਾਬ ਸੀਗੀ ਇਨਕਲਾਬੀ ਉਹਦੇ ਵਿੱਚ ਅਸੀਂ ਇਹ ਵੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਨਕਲਾਬੀ ਜਜ਼ਬੇ ਨੂੰ ਉਹਦੇ ਵਿੱਚ ਬੜੀ ਵਿਸਤਾਰ ਪੂਰਵਕ ਸਮਝਾਇਆ ਸੀ ਕਿ ਸਾਡੀ ਸੋਚ ਜਿਹੜੀ ਇਨਕਲਾਬੀ ਹੋਣੀ ਚਾਹੀਦੀ ਹੈ ਚਾਹੇ ਉਹ ਆਪਣੇ ਕੰਮ ਪ੍ਰਤੀ ਹੋਵੇ ਚਾਹੇ ਉਹ ਆਪਣੇ ਦੇਸ਼ ਪ੍ਰਤੀ ਹੋਵੇ ਚਾਹੇ ਮਾਤਾ ਪਿਤਾ ਦੇ ਪ੍ਰਤੀ ਹੋਵੇ ਸੋ ਉਹਦੇ ਵਿੱਚ ਬਹੁਤ ਸਾਰੇ ਵਿਚਾਰ ਪੇਸ਼ ਕੀਤੇ ਗਏ ਸੀ ਇਨਕਲਾਬੀ ਜਿਵੇਂ ਉਹਦੇ ਤੋਂ ਹੀ ਕ੍ਰਾਂਤੀਕਾਰੀ ਇੱਕ ਸੁਭਾਅ ਦਾ ਪਤਾ ਲੱਗਦਾ ਸੀਗਾ ਉਸ ਰਾਈਟਰ ਦਾ ਉਸ ਲੇਖਕ ਦਾ ਕਿ ਉਸ ਨੇ ਕਿਸ ਤਰ੍ਹਾਂ ਆਪਣੀ ਗੱਲ ਨੂੰ ਦੁਨੀਆ ਦੇ ਸਾਹਮਣੇ ਇੱਕ ਸਿੱਧੇ ਤੌਰ 'ਤੇ ਰੱਖਣ ਦੀ ਜਿਹੜੀ ਕੋਸ਼ਿਸ਼ ਕੀਤੀ ਅਤੇ ਉਹਨੇ ਇਹ ਜਜ਼ਬਾ ਜਿਹੜਾ ਆ ਪੜ੍ਹਨ ਵਾਲੇ ਦੇ ਦਿਮਾਗ ਵਿੱਚ ਵੀ ਰੱਖਿਆ ਕਿ ਸੱਚ ਅਤੇ ਇਨਕਲਾਬੀ ਹੋਣਾ ਬਹੁਤ ਜ਼ਰੂਰੀ ਹੈ ਸੱਚ 'ਤੇ ਜ਼ੋਰਦਾਰ ਆਪਣੀ ਜਿਹੜੀ ਆ ਓਪੀਨੀਅਨ ਸਲਾਹ ਤੁਹਾਡੀ ਇੱਕ ਹੋਣੀ ਚਾਹੀਦੀ ਹੈ ਔਰ ਮੈਂ ਉਹਨਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ ਮੈਂ ਕਿਤਾਬ ਰੀਡਿੰਗ ਕਲੱਬ ਵਿੱਚ ਵੀ ਮੈਂ ਸ਼ਮੂਲੀਅਤ ਕੀਤੀ ਮੈਂ ਉਸ ਵਿੱਚ ਵੀ ਸ਼ਾਮਿਲ ਹੋਈ ਕਿਉਂਕਿ ਜਦੋਂ ਕਿਤਾਬਾਂ ਦੀ ਰੀਡਿੰਗ ਕਰਦੇ ਹਾਂ ਅਤੇ ਸਾਨੂੰ ਬਹੁਤ ਸਾਰੀ ਜਦੋਂ ਆਪਾਂ ਲਿਖਦੇ ਵੀ ਹਾਂ ਤਾਂ ਬਹੁਤ ਸਾਰੀ ਪੇਸ਼ਕਸ਼ ਆਉਂਦੀ ਹੈ ਕਿ ਤੁਸੀਂ ਕਿਤਾਬ ਰੀਡਿੰਗ ਕਲੱਬ ਵਿੱਚ ਸ਼ਾਮਿਲ ਹੋਵੋ ਸੋ ਮੈਂ ਉੱਥੇ ਕਿਤਾਬ ਰੀਡਿੰਗ ਕਲੱਬ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਜਿਹੜੇ ਆ ਉਹ ਇਨਕਲਾਬੀ ਧਾਰਨਾ ਨਾਲ ਸਾਰਿਆਂ ਦੇ ਸਾਹਮਣੇ ਜਿਹੜੇ ਆ ਉਹ ਪੇਸ਼ ਕੀਤੇ ਅਤੇ ਇਸ ਕਿਤਾਬ ਨੇ ਮੇਰੇ ਜੀਵਨ ਦੇ ਵਿੱਚ ਬਹੁਤ ਵੱਡੀ ਤਬਦੀਲੀ ਲਿਆਂਦੀ ਜਿਹਦੇ ਨਾਲ ਮੈਨੂੰ ਅ ਇੱਕ ਦੂਜੇ ਨਾਲ ਸੰਪਰਕ ਕਰਨ ਦੇ ਵਿੱਚ ਇੱਕ ਦੂਜੇ ਨਾਲ ਵਾਰਤਾਲਾਪ ਕਰਨ ਵਿੱਚ ਬਹੁਤ ਆਸਾਨੀ ਹੋਈ ਧੰਨਵਾਦ